ਸਤਿ ਸ਼੍ਰੀ ਅਕਾਲ ਜੀ ਜੀ ਕੀ ਮੈਂ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਜਿਹੜਾ ਸਾਹਿਬ ਆ ਉਸ ਦੇ ਪ੍ਰਬੰਧਕ ਨਾਲ ਹੀ ਗੱਲ ਕਰ ਰਿਹਾਂ ਜੀ ਅੱਛਾ ਜੀ ਦਾਸ ਜੀ ਹੁਣਾਂ ਨੇ ਨਾ ਸੇਵਾ ਲਗਵਾਉਣੀ ਸੀ ਲੰਗਰ ਦੀ ਅਤੇ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਨੂੰ ਫੋਨ ਕੀਤਾ ਸੀ ਅ ਅਸੀਂ ਗੁਰਦੁਆਰਾ ਸਾਹਿਬ ਦੇ ਅਸੀਂ ਚਾਹੁੰਦੇ ਸੀ ਕਿ ਅਸੀਂ ਅਸੀਂ ਨਾ ਚਾਹੁੰਦੇ ਸੀ ਕਿ ਅਸੀਂ ਨਾ ਚਾਹੁੰਦੇ ਸੀ ਕਿ ਅਸੀਂ ਲੰਗਰ ਨਾ ਗੁਰਦੁਆਰਾ ਸਾਹਿਬ ਦੇ ਅੰਦਰ ਲਗਾਈਏ ਅੰਦਰ ਸਾਨੂੰ ਕੋਈ ਥੋੜ੍ਹੀ ਜਿਹੀ ਜਗ੍ਹਾ ਮਿਲ ਜਾਵੇ ਅਤੇ ਅਸੀਂ ਉੱਥੇ ਲੰਗਰ ਦੀ ਸੇਵਾ ਲਗਾ ਸਕਾਂਗੇ ਅਤੇ ਜੇਕਰ ਦਾਸ ਜੀ ਹੋਣੀ ਸਾਨੂੰ ਥੋੜ੍ਹੀ ਜਿਹੀ ਜਗ੍ਹਾ ਦੇ ਦੇਣਗੇ ਅਤੇ ਅਸੀਂ ਅੰਦਰ ਹੀ ਲੰਗਰ ਦਾ ਪ੍ਰਬੰਧ ਕਰ ਸਕਾਂਗੇ ਅਤੇ ਸੰਗਤ ਨੂੰ ਵਰਤਾਇਆ ਜਾਵੇਗਾ ਅਤੇ ਬੜੇ ਆਰਾਮ ਨਾਲ ਸਾਰਾ ਕੁਛ ਹੋ ਜਾਵੇਗਾ ਜੀ ਜੀ ਜੀ ਠੀਕ ਹੈ ਜੀ ਅੱਛਾ ਜੀ ਅੰਦ ਅੰਦਰ ਨਹੀਂ ਮਿਲ ਸਕਦੀ ਜਗ੍ਹਾ ਜੀ ਜੀ ਜੀ ਜੀ ਅੱਛਾ ਜੀ ਅੱਛਾ ਗੁਰਦੁਆਰਾ ਸਾਹਿਬ ਦੇ ਬਾਹਰ ਮਤਲਬ ਉੱਥੇ ਆਪਣੇ ਟੈਂਟ ਲਗਾ ਕੇ ਅਤੇ ਉੱਥੇ ਸਾਰਾ ਅਰੇਂਜਮੈਂਟ ਕਰਨਾ ਪਵੇਗਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਮਤਲਬ ਹੁਣ ਐੱਸ ਜੀ ਪੀ ਸੀ ਅਲਾਓ ਨਹੀਂ ਕਰਦੀ ਜੀ ਅੰਦਰ ਲੰਗਰ ਲਗਾਉਣ ਲਈ ਚਲੋ ਠੀਕ ਹੈ ਜੀ ਧੰਨਵਾਦ ਜੀ